ਹੈਲੋ ਸਵਿਗੀ ਸਤਿ ਸ਼੍ਰੀ ਅਕਾਲ ਮੈਂ ਏ ਐੱਨ ਰੈਸਟੋਰੈਂਟ ਤੋਂ ਇੱਕ ਮਿੱਠੀ ਖੀਰ ਦਾ ਔਡਰ ਦਿੱਤਾ ਸੀ ਮੇਰਾ ਔਡਰ ਨੰਬਰ ਇੱਕ ਦੋ ਤਿੰਨ ਪੰਜ ਹੈ ਮੈਂ ਜਦ ਉਸ ਔਡਰ ਨੂੰ ਖੋਲਿਆ ਤਾਂ ਮੈਨੂੰ ਉਸ ਚੋਂ ਇੱਕ ਅਲੱਗ ਜਿਹੀ ਬਦਬੂ ਆਈ ਉਸ ਨੂੰ ਚੱਖਣ ਤੋਂ ਬਾਅਦ ਮੈਨੂੰ ਪਤਾ ਲੱਗਾ ਇਹ ਖੀਰ ਤਾਂ ਬਾਸੀ ਹੈ ਜਿਵੇਂ ਕਈ ਦਿਨਾਂ ਤੋਂ ਬਣਾਈ ਹੋਵੇ ਮੈਂ ਤੁਹਾਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕਰਨਾ ਚਾਹੁੰਦਾ ਹਾਂ ਅਤੇ ਉਸ ਰੈਸਟੋਰੈਂਟ ਨੂੰ ਹਿਦਾਇਤ ਦੇਣਾ ਚਾਹੁੰਦਾ ਹਾਂ ਕਿ ਆਪਣੇ ਗ੍ਰਾਹਕਾਂ ਨੂੰ ਚੰਗੀ ਚੀਜ਼ ਵੇਚਣ ਨਾ ਕਿ ਇੱਦਾਂ ਦੀ ਖਰਾਬ ਅਤੇ ਬਹੀ ਚੀਜ਼ ਆਪਣੇ ਗ੍ਰਾਹਕਾਂ ਨੂੰ ਦੇਣ ਅਤੇ ਮੈਂ ਤੁਹਾਡੇ ਅੱਗੇ ਦਰਖਾਸਤ ਕਰਦਾ ਹਾਂ ਕਿ ਮੇਰੇ ਸਾਰੇ ਪੈਸੇ ਵਾਪਸ ਕੀਤੇ ਜਾਣ ਅਤੇ ਆਸ਼ਾ ਕਰਦਾ ਹਾਂ ਤੁਸੀਂ ਮੇਰਾ ਇਹ ਸ਼ਿਕਾਇਤ ਦਰਜ ਕਰੋਗੇ ਅਤੇ ਮੇਰੀ ਕਾਰਵਾਈ 'ਤੇ ਛੇਤੀ ਅਮਲ ਕਰੋਗੇ